ਹਾਂ ਮੈਂ ਇਸ ਸਫੋਟੀਫਾਈ ਐਪ ਡਾਊਨਲੋਡ ਕਰਕੇ ਵਰਤਿਆ ਹੈ ਸਫੋਟੀਫਾਈ ਐਪ ਸਾਨੂੰ ਵੱਖ ਵੱਖ ਤਰ੍ਹਾ ਵਿੱਚ ਬਹੁਤ ਜਿਆਦਾ ਹੈਲਪ ਕਰਦਾ ਇਸ ਨਾਲ ਅਸੀਂ ਕਿਸੇ ਵੀ ਟਾਈਮ ਮਿਊਜਿਕ ਸੁਣ ਸਕਦੇ ਆ ਜੋ ਕਿ ਮਿਊਜਿਕ ਇਸ ਚ ਹਰੇਕ ਭਾਸ਼ਾ ਚ ਸਾਨੂੰ ਮਿਊਜਿਕ ਇਜਲੀ ਅਵੇਲੇਬਲ ਹੈ ਸਫੋਟੀਫਾਈ ਤੇ ਜਿਸ ਨਾਲ ਅਸੀਂ ਇਹ ਐਡ ਫਰੀ ਵੀ ਇਹ ਐਡ ਵੀ ਹੁੰਦਾ ਜਿਸ ਨਾਲ ਆਪਾਂ ਪ੍ਰੀਮੀਅਮ ਕ੍ਰਿਕਟ ਆਪਾਂ ਐਪ ਫਰੀ ਇਸਨੂੰ ਕਰ ਸਕਦੇ ਆਂ ਪਰ ਸਫੋਟੀਫਾਈ ਤੇ ਜਿਵੇਂ ਹੋਲੀਵੁੱਡ ਬੋਲੀਵੁੱਡ ਟੋਲੀਬੁੱਡ ਪੋਲੀਵੁੱਡ ਦੇ ਤੇ ਹਰੇਕ ਅੱਡ ਅੱਡ ਭਾਸ਼ਾਵਾਂ ਦੇ ਗਾਣੇ ਆਉਂਦੇ ਹਨ ਜੋ ਕੀ ਪਾਰਟੀ ਪਾਰਟੀ ਮਿਊਜਿਕ ਵੀ ਇਜਲੀ ਅਵੇਲੇਬਲ ਹੈ ਇਹ ਸਾਡੇ ਮੂਡ ਦੇ ਅਕੋਰਡਿੰਗ ਹੈ ਇਸ ਲਈ ਇਸ ਤੇ ਗਾਣੇ ਸੁਣ ਸਕਦੇ ਹਾਂ ਔਨਲਾਈਨ ਡਾਊਨਲੋਡ ਕਰਨ ਦਾ ਬਹੁਤ ਹੀ ਜਿਆਦਾ ਜਰੂਰੀ ਆ ਕਿਉਂਕਿ ਅੱਜ ਕੱਲ ਦੇ ਸਾਰੇ ਲੋਕ ਆਪਣੇ ਫੋਨ ਵਿੱਚ ਇਹ ਐਪ ਡਾਊਨਲੋਡ ਕਰਦੇ ਹਨ ਜਿਸ ਨਾਲ ਅਸੀਂ ਕਿਸੇ ਵੀ ਟਾਈਮ ਕੀਤੇ ਵੀ ਕਿਸੇ ਵੀ ਜਗ੍ਹਾ ਤੇ ਆਪਾਂ ਮਿਊਜਿਕ ਆਰਾਮ ਨਾਲ ਸੁਣ ਸਕਦੇ ਹਾਂ